ਮੈਂ ਜ਼ਿਆਦਾਤਰ ਪਿੰਡ ਵਿੱਚ ਰਹਿੰਦੀ ਹਾਂ ਸਾਡੇ ਪਿੰਡ ਵਿੱਚ ਸਿਹਤ ਸੰਭਾਲ ਨੂੰ ਲੈ ਕੇ ਤਾਂ ਕੋਈ ਤਰ੍ਹਾਂ ਦੀ ਕੋਈ ਡਿਸਪੈਂਸਰੀ ਨਹੀਂ ਹੈ ਕੁਛ ਨਹੀਂ ਜੇ ਡਿਸਪੈਂਸਰੀ ਹੈਗੀ ਏ ਤਾਂ ਉੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਵਾਈ ਨਹੀਂ ਉਪਲਬਧ ਹੁੰਦੀ ਜੇ ਅਸੀਂ ਲੈਣ ਵੀ ਜਾਂਦੇ ਆ ਅਤੇ ਜਿਹੜੇ ਗਰੀਬ ਲੋਕ ਲੈਣ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਦਵਾਈਆਂ ਮੁੱਕੀਆਂ ਹੋਈਆਂ ਨੇ ਜਦੋਂ ਆਉਣਗੀਆਂ ਤੁਹਾਨੂੰ ਲਿਆ ਕੇ ਦਿੱਤੀਆਂ ਜਾਣਗੀਆਂ ਅਤੇ ਜੇ ਆਵਾਸਾਈ ਆਵਾਜਾਈ ਦੇ ਸਾਧਨ ਉਹਨਾਂ ਦੀ ਗੱਲ ਕਰ ਲਈਏ ਤਾਂ ਆਵਾਜਾਈ ਦੇ ਸਾਧਨ ਬਹੁਤ ਜ਼ਿਆਦਾ ਨੇ ਸਾਡੇ ਪਿੰਡ ਦੇ ਵਿੱਚ ਅਤੇ ਪਰ ਉਹਨਾਂ ਦੇ ਜਿਵੇਂ ਰੋਡ ਆ ਸਾਡੇ ਹੈ ਨਾ ਸਾਰੇ ਟੁੱਟੇ ਹੋਏ ਨੇ ਅਤੇ ਇੱਕ ਸਿੰਗਲ ਰੋਡ ਹੈ ਸਾਡੇ ਪਿੰਡ ਦੇ ਵਿੱਚ ਜਿਹੜਾ ਕਿ ਸਾਡੇ ਇਸ ਪਿੰਡ ਨੂੰ ਬਹੁਤ ਘੱਟ ਪੈਂਦਾ ਅਤੇ ਸੜਕ ਸਗੋਂ ਡਬਲ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ ਪਿੰਡ ਇੱਕ ਪਿੰਡ ਜਿਹੜਾ ਹੈ ਚਾਰ ਪਿੰਡਾਂ ਦੇ ਬਰਾਬਰ ਆ ਅਤੇ ਇਸ ਹਿਸਾਬ ਨਾਲ ਸਾਡੇ ਤਾਂ ਆਵਾਜਾਈ ਬਹੁਤ ਹੁੰਦੀ ਆ ਅਤੇ ਉੱਥੇ ਸਾਨੂੰ ਲਾਈਟਾਂ ਵੀ ਚਾਹੀਦੀਆਂ ਲਵਾਉਣੀਆਂ ਇਹਨਾਂ ਨੂੰ ਕਿ ਜਦੋਂ ਰਾਤ ਦਾ ਟਾਈਮ ਹੁੰਦਾ ਹਨੇਰਾ ਹੁੰਦਾ ਕੁਛ ਨਹੀਂ ਪਤਾ ਲੱਗਦਾ ਹੈ ਨਾ ਧੁੰਦਾਂ ਦੇ ਟਾਈਮ ਵੀ ਕੁਛ ਨਹੀਂ ਪਤਾ ਲੱਗਦਾ ਕਿੱਥੋਂ ਕੀ ਹੋ ਜਾਣਾ ਹੈ ਨਾ ਕਿ ਕਿੱਦਾਂ ਐਕਸੀਡੈਂਟ ਹੋ ਜਾਣਾ ਅਤੇ ਰਾਤ ਦੇ ਟਾਈਮ ਦੇ ਵਾਸਤੇ ਲੈਟਾਂ ਵੀ ਚਾਹੀਦੀਆਂ ਨੇ ਕੋਈ ਪ੍ਰਬੰਧ ਨਹੀਂ ਹੈ ਇਸ ਤਰ੍ਹਾਂ ਦਾ ਅਤੇ ਅਸੀਂ ਸਰਕਾਰ ਨੂੰ ਇਹੀ ਕਵਾਂਗੇ ਹੈ ਨਾ ਕਿ ਸਾਡੇ ਜਿਹੜੇ ਇਹਨਾਂ ਸਿਹਤ ਸੰਭ ਸਿਹਤ ਸੰਭਾਲ ਦੇ ਡਿਸਪੈਂਸਰੀਆਂ ਵਗੈਰਾ ਨੇ ਜਾਂ ਆਵਾਜਾਈ ਦੇ ਕ ਕਮੀਆਂ ਨੇ ਹੈ ਨਾ ਜਿਹੜੀਆਂ ਲੋੜਾਂ ਸਾਡੀਆਂ ਦੀ ਘਾਟ ਆ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਜੇ ਸਿੱਖਿਆ ਨੂੰ ਲੈ ਕੇ ਗੱਲ ਕਰੀਏ ਤਾਂ ਸਕੂਲ ਹੈ ਉਹਨਾਂ ਦਾ ਵੀ ਬਹੁਤ ਮਾੜਾ ਹਾਲ ਆ ਹੈ ਨਾ ਜਿਹੜੀਆਂ ਉਹਨਾਂ ਦੀਆਂ ਛੱਤਾਂ ਆ ਉਹ ਚੌਂਦੀਆਂ ਆ ਅਤੇ ਉੱਥੇ ਜਿਹੜਾ ਸਿੱਖਿਆ ਦਾ ਪ੍ਰਚਾਰ ਆ ਉਹ ਵੀ ਬਹੁਤ ਘੱਟ ਆ ਜਿਹੜੇ ਟੀਚਰ ਆ ਉਹ ਪੜਾਉਦੇ ਦੇ ਬਹੁਤ ਘੱਟ ਨੇ ਜ਼ਿਆਦਾਤਰ ਪ੍ਰੋਜੈਕਟਾਂ 'ਤੇ ਜਿਹੜੇ ਨਿਆਣੇ ਆ ਉਹਨਾਂ ਨੂੰ ਲੈਸਨ ਲਗਾ ਕੇ ਦੇ ਦਿੰਦੇ ਆ ਬਸ ਨਿਆਣਿਆਂ ਨੂੰ ਬੈਠੇ ਕਹਿ ਕੇ ਕਹਿ ਦਿੰਦੇ ਆ ਬੈਠ ਕੇ ਤੁਸੀਂ ਲਿਖੀ ਜਾਓ ਉਹਨਾਂ ਨੂੰ ਪੜ੍ਹਾਉਣ ਦਾ ਕੋਈ ਢੰਗ ਨਹੀਂ ਹੈਗਾ ਅਤੇ ਉਹਨਾਂ ਵੱਲ ਵੀ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਆ ਅਤੇ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਜਿਹੜੀ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣਾ ਦੇਣ ਕਿ ਜਿਹੜਾ ਸਾਡਾ ਸਿਹਤ ਸੰਭਾਲ ਆ ਉਹਨਾਂ ਦੇ ਵੱਲ ਵੀ ਧਿਆਨ ਦੇਣ ਕਿ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਉੱਥੋਂ ਡਿਸਪੈਂਸਰੀਆਂ ਤੋਂ ਦਵਾਈਆਂ ਮੁਹੱਈਆ ਕਰਵਾਈ ਜਾਵੇ ਹੈ ਨਾ ਅਤੇ ਜਿਹੜੇ ਕਈ ਲੋਕ ਇੱਦਾਂ ਹੀ ਆ ਜਿਹੜੇ ਜਿਹਨਾਂ ਨੂੰ ਦਵਾਈ ਨਹੀਂ ਮਿਲਦੀ ਅਤੇ ਉਹ ਆਪਣੀ ਬਿਮਾਰੀ ਨੂੰ ਠੀਕ ਕਰਾਉਣ ਦੇ ਇਲਾਜ ਕਰਾਉਣ ਵਿੱਚ ਪਿੱਛੇ ਰਹਿ ਜਾਂਦੇ ਆ ਹੈ ਨਾ ਅਤੇ ਸਿੱਖਿਆ ਨੂੰ ਇਹ ਲੈ ਕੇ ਜਿਹੜੇ ਸ ਬੱਚੇ ਆ ਉਹ ਪ ਪੜ੍ਹੇ ਪੜ੍ਹ ਇੱਕ ਹਿਸਾਬ ਦੇ ਪੜ੍ਹੇ ਵੀ ਹੋਣ ਤਾਂ ਅਨਪੜ੍ਹ ਹੀ ਕਹਿ ਸਕਦੇ ਹਾਂ ਆਪਾਂ ਉਹਨਾਂ ਨੂੰ ਅਤੇ ਪੜ੍ਹੇ ਲਿਖੇ ਨਹੀਂ ਵੀ ਹੁੰਦੇ ਅਤੇ ਬਸ ਸਰਕਾਰ ਇਹ ਅਪੀਲ ਹੈ ਕਿ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ